ਹੋਰ ਭਾਸ਼ਾਵਾਂ ਵਿੱਚ ਲਿਖਣ ਦੇ ਮੁਕਾਬਲੇ ਪੰਜਾਬੀ ਵਿੱਚ ਲਿਖਣਾ ਇਹ ਬਹੁਤ ਹੀ ਸੌਖਾ ਹੈ ਕਿਉਂਕਿ ਮੇਰੀ ਬੋਲੀ ਹੀ ਪੰਜਾਬੀ ਹੈ ਮੇਰੀ ਮਾਂ ਬੋਲੀ ਪੰਜਾਬੀ ਹੈ ਅਤੇ ਮਾਂ ਬੋਲੀ ਦੇ ਵਿੱਚ ਆਪਣੇ ਵਿਚਾਰਾਂ ਨੂੰ ਪ੍ਰਗਟ ਦੇਣਾ ਅਤੇ ਉਹਨਾਂ ਨੂੰ ਇੱਕ ਰੂਪ ਦੇਣਾ ਹਮੇਸ਼ਾ ਤੋਂ ਹੀ ਆਸਾਨ ਰਿਹਾ ਹੈ ਬਾਕੀ ਸਕੂਲੀ ਪੜ੍ਹਾਈ ਦੇ ਵਿੱਚ ਕਿਉਂਕਿ ਮੇਰੀ ਸਬਜੈਕਟ ਹੀ ਪੰਜਾਬੀ ਸਨ ਉਹਨੇ ਮੇਰੀ ਪੰਜਾਬੀ ਦੀ ਸੋਚ ਨੂੰ ਪੰਜਾਬੀ ਦੀ ਪੰਜਾਬੀ ਦੀ ਲਿਖਣ ਦੀ ਕਲਾ ਨੂੰ ਬਹੁਤ ਜ਼ਿਆਦਾ ਸਵਾਰਿਆ ਹੈ